ਪੰਜ ਜੁਲਾਈ ਦੋ ਹਜ਼ਾਰ ਦੋ ਅੱਠ ਜੂਨ ਦੋ ਹਜ਼ਾਰ ਇੱਕ ਪੰਜ ਅਕਤੂਬਰ ਦੋ ਹਜ਼ਾਰ ਤਿੰਨ ਛੱਬੀ ਅਕਤੂਬਰ ਉੱਨੀ ਸੌ ਅੱਸੀ ਨੌਂ ਨਵੰਬਰ ਦੋ ਹਜ਼ਾਰ ਇੱਕ